ਪੰਜਾਬ ਦੋ ਅੱਖਰਾਂ ਦੇ ਮੇਲ ਤੋਂ ਬਣਿਆ ਹੈ ਪੰਜ ਪਲੱਸ ਆਬ ਪੰਜਾਬ ਦੇ ਲੋਕ ਅਤੇ ਲੋਕਾਂ ਦੀ ਬੋਲੀ ਬਹੁਤ ਹੀ ਨਿਰਾਲੀ ਹੈ ਜਿਵੇਂ ਵੱਖ ਵੱਖ ਇਲਾਕਿਆਂ ਦੀ ਬੋਲੀ ਦਾ ਅੰਤਰ ਥੋੜ੍ਹਾ ਵੱਖਰਾ ਹੁੰਦਾ ਹੈ ਅਤੇ ਵੱਖ ਵੱਖ ਦੇਸ਼ਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਲੋਕ ਰਹਿੰਦੇ ਹਨ ਅਤੇ ਵੱਖ ਵੱਖ ਤਰ੍ਹਾਂ ਦੀ ਬੋਲੀ ਬੋਲਦੇ ਹਨ ਜੇਕਰ ਬੋਲੀ ਦੀ ਭਾਵਨਾ ਨੂੰ ਪ੍ਰਗਟ ਕਰਨ ਲਈ ਅਸੀਂ ਆਖਦੇ ਉਸ ਨੂੰ ਸ਼ਬਦਾਂ 'ਚ ਲਕੋਕਤੀਆਂ 'ਚ ਗੀਤਾਂ ਅਤੇ ਰੋਜ਼ ਦੀ ਜ਼ਿੰਦਗੀ 'ਚ ਅਸੀਂ ਜਦੋਂ ਕਿਸੇ ਨੂੰ ਮਿਲਦੇ ਹਾਂ ਤਾਂ ਉਸਨੂੰ ਨਮਸਤੇ ਜਾਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਜੇ ਕਿਸੇ ਕੋਲ ਰਹਿਣ ਜਾਈਏ ਜਾਂਦੇ ਹਾਂ ਉਸ ਨੂੰ ਅਸੀਂ ਗਲੇ ਮਿਲਦੇ ਹਾਂ ਅੱਜ ਕੱਲ੍ਹ ਤਾਂ ਇਹ ਸਭ ਗੀਤਾਂ ਵਿੱਚ ਦਿਖਾਇਆ ਜਾਂਦਾ ਹੈ ਜੇਕਰ ਗੁਰਦਾਸ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਗੀਤ ਪੰਜਾਬ ਨੂੰ ਦਿਖਾਉਂਦੇ ਹਨ ਕਿ ਪੰਜਾਬ 'ਚ ਕਿੱਦਾਂ ਦਾ ਵਿਵਹਾਰ ਚੱਲਦਾ ਅਤੇ ਕਿੱਦਾਂ ਦੀ ਬੋਲੀ ਬੋਲੀ ਜਾਂਦੀ ਹੈ ਅਤੇ ਕਿੱਦਾਂ ਦੇ ਲੋਕ ਇੱਕ ਦੂਜੇ ਨੂੰ ਮਿਲਦੇ ਹਨ